ਪੰਜਾਬ ਵਿੱਚ ਰਾਜ ਸਰਕਾਰ ਸਾਰੇ ਨਾਗਰਿਕਾਂ ਲਈ ਬਰਾਬਰ ਪ੍ਰਤੀਨਿਧਤਾ ਬਹੁਤ ਬਹੁਤ ਵਧੀਆ ਕੀਤੀ ਹੈ ਕਿਉਂਕਿ ਉਹਦੇ ਵਿੱਚ ਜਿਵੇਂ ਵਿਲੇਜ ਦੇ ਪੰਚਾਇਤ ਨਾ ਇਹ ਹੋਰ ਜਿਹੜੇ ਸਟੇਟ ਇਲੈਕਸ਼ਨ ਇਹ ਵਾਲੇ ਕੰਮ ਸ਼ੁਰੂ ਹੋ ਗਏ ਨੇ ਇਹਦੇ ਨਾਲ ਸਾਡਾ ਬਹੁਤ ਵਧੀਆ ਕੰਮ ਹੋ ਗਿਆ ਵੇ ਇੱਕ ਤਾਂ ਜਿਹੜੀ ਪੰਜਾਬ ਸਰਕਾਰ ਨੇ ਬਿਜਲੀ ਦਾ ਕੀਤਾ ਵੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਨੇ ਇੱਕ ਮਹੀਨੇ ਦੇ ਵਿੱਚ ਤਿੰਨ ਸੌ ਯੂਨਿਟ ਦੋ ਮਹੀਨੇ 'ਚ ਛੇ ਸੌ ਯੂਨਿਟ ਅਤੇ ਦੋ ਮਹੀਨੇ ਦਾ ਬਿਜਲੀ ਦਾ ਬਿਲ ਆਉਂਦਾ ਵੇ ਅਤੇ ਉਹ ਸਾਡਾ ਹੁਣ ਕਿੰਨੇ ਚਿਰ ਹੋ ਗਏ ਜਦੋਂ ਦਾ ਸਰਕਾਰ ਨੇ ਮਾਫ ਕੀਤਾ ਵੇ ਉਹ ਸਾਡਾ ਹੁਣ ਕਦੀ ਬਿਜਲੀ ਦਾ ਬਿੱਲ ਆਇਆ ਹੀ ਨਹੀਂ ਨਹੀਂ ਤਾਂ ਸਾਡੇ ਦਸ ਬਾਰ੍ਹਾਂ ਹਜ਼ਾਰ ਬਿਲ ਆਉਂਦਾ ਸੀ ਹਰ ਮਹੀਨੇ ਅਤੇ ਉਹ ਹੁਣ ਸਾਡਾ ਮਾਫ ਹੋ ਗਿਆ ਵੇ ਉਹਦੇ ਨਾਲ ਸਾਡੇ ਕਿੰਨੇ ਹੋਰ ਖਰਚੇ ਜਿਹੜੇ ਬੱਚਿਆਂ ਦੀ ਫੀਸਾਂ ਆਰਾਮ ਨਾਲ ਦਿੱਤੀਆਂ ਜਾਂਦੀਆਂ ਨੇ ਰਾਸ਼ਨ ਕਿੰਨਾ ਖੁੱਲਾ ਤਰੀਕੇ ਨਾਲ ਅਸੀਂ ਵਰਤ ਲਈਦਾ ਵੇ ਇਸ ਤਰ੍ਹਾਂ ਸਾਰੇ ਬੜੇ ਵਧੀਆ ਹੋ ਗਿਆ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰਦੀ ਪਈ ਹੈ ਹੁਣ ਸਾਨੂੰ ਪੰਜਾਬ ਸਰਕਾਰ ਨਾਲ ਪਹਿਲੇ ਹਮੇਸ਼ਾ ਸ਼ਿਕਾਇਤ ਹੀ ਹੁੰਦੀ ਸੀ ਪਰ ਹੁਣ ਅਸੀਂ ਬੜੀ ਤਸੱਲੀ ਬਖਸ਼ ਅਸੀਂ ਖੁਸ਼ ਹੈਗੇ ਹਾਂ ਪੰਜਾਬ ਸਰਕਾਰ ਤੋਂ ਧੰਨਵਾਦ ਜੀ